ਇਹ ਮੰਨਿਆਂ ਜਾਂਦਾ ਹੈ ਕਿ ਵੱਖ ਵੱਖ ਕਿਸਮਾਂ ਦੀ ਯਾਤਰਾਵਾਂ ਲਈ ਆਵਾਜਾਈ ਦਾ ਸਭ ਤੋਂ ਵਧੀਆ ਸਾਧਨ ਬੱਸ ਕਾਰਾਂ ਟਰੇਨ ਅਤੇ ਬੱਸਾਂ ਦਾ ਸਫਰ ਮੰਨਿਆਂ ਜਾਂਦਾ ਹੈ ਜਿਵੇਂ ਕਿ ਅਗਰ ਤਰਨਤਾਰਨ ਤੋਂ ਅਨੰਦਪੁਰ ਸਾਹਿਬ ਜਾਂ ਕਿਤੇ ਹੋਰ ਯਾਤਰਾ ਜਾਣੀ ਹੋਵੇ ਤਾਂ ਸਾਰੇ ਸ਼ਰਧਾਲੂ ਸਾਰੀ ਸੰਗਤ ਇਕੱਠੀ ਹੋ ਕੇ ਬੱਸਾਂ ਵਿੱਚ ਜਾਂਦੀ ਹੈ ਉਹ ਸਾਰੇ ਸਫਰ ਵਿੱਚ ਕੀਰਤਨ ਦੇ ਆਨੰਦ ਮਾਣਦੇ ਹਨ ਲੰਗਰ ਪ੍ਰਸ਼ਾਦਾ ਇਕੱਠੇ ਛੱਕਦੇ ਹਨ ਜਿਹਦੇ ਨਾਲ ਕਿ ਉਹ ਇਕੱਠੇ ਟਾਈਮ ਸਪੈਂਡ ਵੀ ਕਰ ਲੈਂਦੇ ਹਨ ਅਤੇ ਯਾਤਰਾ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਲੈਂਦੇ ਹਨ ਹੋਰ ਦੇਖਿਆ ਜਾਵੇ ਤਾਂ ਵਿਸਾਖੀ ਦੇ ਦਿਨਾਂ ਵਿੱਚ ਜਾਂ ਆਨੰਦਪੁਰ ਸਾਹਿਬ ਜਦੋਂ ਮੇਲਾ ਲੱਗਦਾ ਹੈ ਤਾਂ ਬਹੁਤ ਨੌਜਵਾਨ ਮੋਟਰਸਾਇਕਲ 'ਤੇ ਸਵਾਰ ਹੋ ਕੇ ਮੇਲਾ ਦੇਖਣ ਜਾਂਦੀਆਂ ਹਨ ਓਹ ਵੀ ਦ੍ਰਿਸ਼ ਬਹੁਤ ਨਜਾਰੇਦਾਇਕ ਹੁੰਦਾ ਹੈ ਸਾਨੂੰ ਵੱਖ ਵੱਖ ਦ੍ਰਿਸ਼ ਦਾ ਆਨੰਦ ਮਾਨਣ ਦਾ ਮੌਕਾ ਮਿਲਦਾ ਹੈ ਨੌਜਵਾਨ ਬਹੁਤ ਪ੍ਰਸੰਨ ਹੁੰਦੇ ਹਨ ਅਤੇ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਵਿਖੇ ਜਾ ਕੇ ਮੱਥਾ ਟੇਕ ਕੇ ਪ੍ਰਸੰਨ ਹੁੰਦੇ ਹਨ ਅਤੇ ਆਨੰਦ ਮਾਣਦੇ ਹਨ ਹੋਰ ਵੀ ਦੇਖਿਆ ਜਾਏ ਤਾਂ ਟਰੇਨਾਂ ਦੇ ਵਿੱਚ ਵੀ ਯਾਤਰਾਵਾਂ ਕਰਨ ਦਾ ਸਫਰ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਟਰੇਨ ਸਭ ਤੋਂ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਕਿਤੇ ਵੀ ਕੋਈ ਰੁਕਾਵਟ ਨਹੀਂ ਹੁੰਦੀ ਪੂਰੇ ਟਾਇਮ 'ਤੇ ਟਰੇਨ ਚੱਲਦੀ ਹੈ ਅਤੇ ਪੂਰੇ ਟਾਇਮ 'ਤੇ ਸਾਨੂੰ ਆਪਣੀ ਡੈਸਟੀਨੇਸ਼ਨ 'ਤੇ ਪਹੁੰਚਾ ਦਿੰਦੀ ਹੈ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਯਾਤਰਾਵਾਂ ਲਈ ਵਰਤੋਂ ਕੀਤੀ ਜਾਂਦੀ ਹੈ